ਸਤਿ ਸ਼੍ਰੀ ਅਕਾਲ ਸਰ ਮੈਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣਾ ਸੀਗਾ ਆਪਣੇ ਦੋਸਤਾਂ ਦੇ ਪਰਿਵਾਰ ਦੇ ਨਾਲ਼ ਅਤੇ ਅੱਠ ਦਸ ਜਾਣੇ ਹੋਣਗੇ ਅਤੇ ਗੱਡੀ ਦਾ ਕਿਰਾਇਆ ਕਿੰਨਾ ਪਰ ਕਿਲੋਮੀਟਰ ਦੇ ਹਿਸਾਬ ਨਾਲ਼ ਕਿੰਨਾ ਹੋਵੇਗਾ ਅਤੇ ਡਰਾਈਵਰ ਦਾ ਖਾਣਾ ਪੀਣਾ ਅਤੇ ਰਹਿਣਾ ਵੀ ਉੱਥੀ ਹੋਵੇਗਾ ਉੱਥੇ ਦੋ ਦਿਨ ਹੀ ਰਹਿਣਾ ਹੈ ਅਤੇ ਬਾਕੀ ਜੋ ਕਿਰਾਇਆ ਬਣਦਾ ਹੈ ਡਰਾਈਵਰ ਦਾ ਉਹ ਦੱਸ ਦਿਓ ਧੰਨਵਾਦ